ਹਾਂਜੀ ਸ਼ਿਵ ਸ਼ਕਤੀ ਸਵੀਟਸ ਮੋਹਾਲੀ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਗੁਰਸੇਵਕ ਸਿੰਘ ਗੱਲ ਕਰ ਰਿਹਾ ਜੀ ਸੱਤ ਫੇਜ਼ ਮੋਹਾਲੀ ਤੋਂ ਅਸਲ ਵਿੱਚ ਮੇਰੇ ਨਾ ਦੋਸਤ ਦਾ ਬਰਡੇ ਪਾਰਟੀ ਹੈ ਅਤੇ ਉਹਦੇ ਲਈ ਸਾਡਾ ਸੌ ਤੋਂ ਸਵਾ ਸੌ ਬੰਦੇ ਦਾ ਅਰੇਂਜਮੈਂਟ ਹੈ ਉਹਦੇ ਵਿੱਚ ਸਾਨੂੰ ਅਸੀਂ ਸਾਡੇ ਗੈਸਟ ਜਿਹੜੇ ਆਉਣਗੇ ਅਸੀਂ ਉਹਦੇ ਲਈ ਖਾਣੇ ਦਾ ਸਾਨੂੰ ਸਿਸਟਮ ਚਾਹੀਦਾ ਉਹਦੇ ਵਿੱਚ ਖਾਣੇ ਵਿੱਚ ਅਸੀਂ ਰੋਟੀ ਵੀ ਦੇਣੀ ਹੈ ਇੱਕ ਦਾਲ ਹੋਏਗੀ ਅਤੇ ਇੱਕ ਸਬਜ਼ੀ ਅਤੇ ਇੱਕ ਪਨੀਰ ਅਤੇ ਇੱਕ ਸਾਰੇ ਮਹਿਮਾਨਾਂ ਦੇ ਲਈ ਮਿੱਠਾ ਪਹਿਲਾਂ ਵੀ ਮੈਂ ਤੁਹਾਡੀ ਦੁਕਾਨ ਤੋਂ ਅਕਸਰ ਆਉਂਦਾ ਜਾਂਦਾ ਰਹਿੰਦਾ ਤੁਹਾਡਾ ਦੁਕਾਨ ਦਾ ਬੜਾ ਨਾਮ ਸੁਣਿਆ ਅਤੇ ਸਾਨੂੰ ਇਹ ਚਾਹੀਦਾ ਤਕਰੀਬਨ ਡੇਟ ਹੈਗੀ ਹੈ ਪੰਦਰਾਂ ਸਤੰਬਰ ਦੋ ਹਜ਼ਾਰ ਤੇਈ ਸਾਨੂੰ ਸ਼ਾਮ ਨੂੰ ਸੱਤ ਵਜੇ ਇਸ ਖਾਣਾ ਜਿਹੜਾ ਹੈਗਾ ਸਾਰਾ ਚਾਹੀਦਾ ਅਤੇ ਪਲੀਜ਼ ਤੁਸੀਂ ਮੈਨੂੰ ਇਹ ਦੱਸੋ ਵੀ ਮੈਨੂੰ ਇਹ ਜਿਹੜਾ ਖਾਣਾ ਹੈ ਸੌ ਤੋਂ ਸਵਾ ਸੌ ਬੰਦੇ ਦਾ ਇਹਦਾ ਕਿੰਨਾ ਰੇਟ ਪਏਗਾ ਔਰ ਤੁਸੀਂ ਮੈਨੂੰ ਇਸ ਖਾਣੇ ਦੇ ਲਈ ਕਿੰਨਾ ਡਿਸਕਾਊਂਟ ਦੇ ਸਕਦੇ ਹੋ ਅਤੇ ਇੱਕ ਬੇਨਤੀ ਹੋਰ ਹੈ ਕਿ ਜਿਹੜਾ ਖਾਣਾ ਮੈਨੂੰ ਬਿਲਕੁਲ ਫਰੈਸ਼ ਚਾਹੀਦਾ ਕਿਉਂਕਿ ਮੇਰੇ ਜਿਹੜੇ ਗੈਸਟ ਆਉਣਗੇ ਮੇ ਜੇ ਜਿਹੜੇ ਮੇਰੇ ਮਹਿਮਾਨ ਆਉਣਗੇ ਉਹ ਕਾਫੀ ਵਧੀਆ ਫੈਮਲੀ ਤੋਂ ਬਿਲੋਂਗ ਕਰਦੇ ਨੇ ਅਤੇ ਮੈਨੂੰ ਕਿਸੇ ਤਰ੍ਹਾਂ ਦੀ ਵੀ ਖਾਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਤਲਬ ਦਿੱਕਤ ਨਾ ਕੋਈ ਆਵੇ ਔਰ ਨਾ ਮੈਨੂੰ ਕੋਈ ਅਲਾਂਭਾ ਆਵੇ ਕਿਰਪਾ ਕਰਕੇ ਮੈਨੂੰ ਜਿਹੜਾ ਹੈਗਾ ਇਹ ਦੱਸੋ ਸਾਰਾ ਬਣਾ ਕੇ